ਹੈਲੋ ਹਾਂਜੀ ਜਿਉਂਦਾ ਰਹਿ ਵਧੀਆ ਸ਼ਤੀਸ਼ ਤੂੰ ਦੱਸ ਹੋਰ ਠੀਕ ਆ ਤੂੰ ਉਹ ਵੀ ਵਧੀਆ ਘਰ ਸਭ ਠੀਕ ਠਾਕ ਹੈ ਤੂੰ ਆਪਣੇ ਸੁਣਾ ਠੀਕ ਹੈ ਤੂੰ ਅੱਛਾ ਹੋਰ ਪੜ੍ਹਾਈ ਕਿਵੇਂ ਚਲਦੀ ਹੈ ਤੇਰੀ ਹਾਂ ਜ਼ਿਆਦਾ ਜ਼ਿਆਦਾ ਟੈਂਸ਼ਨ ਨਾ ਲਿਆ ਕਰ ਚਲ ਕੋਈ ਗੱਲ ਨਹੀਂ

ਹਾਂ ਐਵੇਂ ਤਾਂ ਚੱਲ ਕੋਈ ਗੱਲ ਨਹੀਂ ਪਰ ਜ਼ਿਆਦਾ ਟੈਂਸ਼ਨ ਨਾ ਲਿਆ ਕਰ ਕੋਈ ਗੱਲ ਨਹੀਂ ਜੋ ਹੋਣਾ ਹੋਣਾ ਹੀ ਆ

ਅੱਛਾ ਅੱਛਾ ਕਿੱਥੋਂ ਕਿੱਥੋਂ ਦੇ ਤੇਰੇ ਰੂਮਮੇਟਸ ਅੱਛਾ ਅੱਛਾ ਔਰ ਵਧੀਆ ਸਾਰੇ ਉਹ ਅੱਛਾ ਸਭ ਵਧੀਆ ਠੀਕ ਠਾਕ ਹੈ ਹੋਰ ਦੱਸ ਪੈਸਿਆਂ ਪੁਸਿਆਂ ਦੀ ਤਾਂ ਨਹੀਂ ਲੋੜ ਹੈਗੀ ਤੈਨੂੰ ਅੱਛਾ ਅੱਛਾ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਦੱਸ ਦੀ ਠੀਕ ਹੈ ਨਾ ਜਦੋਂ ਲੋੜ ਹੋਵੇ ਤਾਂ ਹੋਰ ਸਭ ਠੀਕ ਠਾਕ ਹੈ ਅੱਛਾ ਅੱਛਾ ਹਾਂ ਹਾਂ ਉਹ ਤਾਂ ਕੋਈ ਗੱਲ ਨਹੀਂ ਚਲੋ ਮੈਂ ਦੇਖਦਾ ਹੀ ਰਹਿੰਦਾ ਇੱਥੇ ਹਾਂ ਉਹਦੀ ਟੈਂਸ਼ਨ ਨਾ ਲਿਆ ਕਰ ਤੂੰ ਜ਼ਿਆਦਾ ਤੂੰ ਬਸ ਤੇਰਾ ਪੜ੍ਹਾਈ 'ਚ ਧਿਆਨ ਰੱਖ ਹੋਰ ਇੱਧਰ ਗੇੜੀਆਂ ਗੂੜੀਆਂ 'ਤੇ ਨਾ ਜਾਇਆ ਕਰ ਵਾਹਲਾ ਠੀਕ ਹੈ ਨਾ ਹਾਂ ਹਾਂ ਹਾਂ ਬਸ ਆਪਣਾ ਪੜ੍ਹਨ ਪੜ੍ਹਨ ਵੱਲ ਧਿਆਨ ਰੱਖਿਆ ਕਰ ਸਿਰਫ਼ ਤੂੰ ਪੜ੍ਹਨਾ ਹੀ ਹੈ ਪੜ੍ਹਨ ਲਈ ਹੀ ਜਾਣਾ ਤੇਰੇ 'ਤੇ ਉਮੀਦਾਂ ਸਾਰੇ ਘਰ ਦੀਆਂ ਠੀਕ ਹੈ ਨਾ ਹਾਂ ਪਰ ਆਪਣਾ ਪੜ੍ਹਨ ਵੱਲ ਹੀ ਧਿਆਨ ਰੱਖ ਹਾਂ ਹਾਂ ਹਾਂ ਹਾਂ ਹਾਂ ਹੋਰ ਖਾਣੇ ਪੀਣੇ ਦਾ ਵਧੀਆ ਚੱਲ ਰਿਹਾ ਤੇਰਾ ਅੱਛਾ ਅੱਛਾ ਵਧੀਆ ਮਿਲਦਾ ਮੈੱਸ ਦਾ ਖਾਣਾ ਹਾਂ ਹਾਂ ਚਲੋ ਅਡਜਸਟਮੈਂਟ ਤਾਂ ਕਰਨੀ ਪੈਂਦੀ ਹੈ ਹਾਂ ਹੋਰ ਖਿਆਲ ਰੱਖਿਆ ਕਰ ਆਪਣਾ ਫਿਰ ਠੀਕ ਹੈ ਹਾਂ ਚੱਲ ਹਾਂ ਹਾਂ ਚਲੋ ਠੀਕ ਹੈ ਫਿਰ ਠੀਕ ਹੈ ਠੀਕ ਸਤਿ ਸ਼੍ਰੀ ਅਕਾਲ